ਸਾਡੇ ਪਰਿਵਾਰ ਵਿੱਚ ਅਸੀਂ ਦੋ ਭਰਾ ਅਤੇ ਇੱਕ ਭੈਣ ਹਨ ਜੋ ਕਿ ਸਾਰੇ ਅੱਜ ਦੇ ਟਾਈਮ ਵਿੱਚ ਆਪਣਾ ਪੜ੍ਹ ਲਿਖ ਕੇ ਆਪਣੇ ਆਪਣੇ ਕਿੱਤੇ ਵਿੱਚ ਜੌਬ ਕਰ ਰਹੇ ਹਨ ਕਿ ਜਿਵੇਂ ਕਿ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਜੋ ਭੈਣ ਨੇ ਉਹ ਇੱਕ ਅਧਿਆਪਕਾ ਨੇ ਅਤੇ ਮੇਰਾ ਭਰਾ ਇੱਕ ਬੈਂਕ 'ਚ ਜੌਬ ਕਰਦਾ ਏ ਅਤੇ ਮੈਂ ਇੱਕ ਸਰਕਾਰੀ ਮੁਲਾਜ਼ਮ ਆ ਮੈਨੂੰ ਇਹ ਜਾਣ ਕੇ ਮਹਿਸੂਸ ਹੁੰਦਾ ਹੈ ਕਿ ਅਸੀਂ ਤਿੰਨੋਂ ਅੱਜ ਦੇ ਟਾਈਮ 'ਚ ਪੜ੍ਹ ਲਿਖ ਕੇ ਆਪਣੇ ਮਾਪਿਆਂ ਦੇ ਸਿਰ 'ਤੇ ਕੋਈ ਬੋਝ ਨਹੀਂ ਬਣੇ ਅਤੇ ਉਨ੍ਹਾਂ ਦੀ ਸੇਵਾ ਕਰ ਰਹੇ ਹਾਂ ਜੋ ਕਿ ਅੱਜ ਦੇ ਟਾਈਮ ਵਿੱਚ ਬਹੁਤ ਹੀ ਲੋੜੀਂਦੀ ਚੀਜ਼ ਵੀ ਹੈ ਕਿ ਆਪਾਂ ਆਪਣੇ ਮਾਂ ਮਾਪਿਆਂ ਨੂੰ ਸਾਂਭੀਏ ਅਤੇ ਆਪਾਂ ਰਲ ਮਿਲ ਕੇ ਭੈਣ ਭਰਾ ਇੱਕ ਇਕੱਠੇ ਸਮਾਜ ਵਿੱਚ ਰਹੀਏ ਜਦੋਂ ਕੋਈ ਕੋਈ ਮੁਸੀਬਤ ਆਉਂਦੀ ਹੈ ਤਾਂ ਅਸੀਂ ਤਿੰਨੋਂ ਭੈਣ ਭਰਾ ਇਕੱਠੇ ਹੋ ਕੇ ਇੱਕ ਦੂਜੇ ਦੀ ਮਦਦ ਕਰਦੇ ਹਾਂ ਜੋ ਕਿ ਅੱਜ ਕੱਲ੍ਹ ਹਰੇਕ ਦਾ ਫਰਜ਼ ਵੀ ਬਣਦਾ ਹੈ ਕਰਨਾ